ਜ਼ਿੰਦਗੀ ਵਿੱਚ ਖੇਡਾਂ ਕਿਉਂ ਜ਼ਰੂਰੀ ਹਨ ਸਾਡੀ ਜ਼ਿੰਦਗੀ ਵਿੱਚ ਖੇਡਾਂ ਬਹੁਤ ਹੀ ਜ਼ਰੂਰੀ ਹਨ ਖੇਡਾਂ ਨਾਲ ਸਭ ਤੋਂ ਪਹਿਲਾ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਦੂਸਰਾ ਖੇਡਾਂ ਖੇਡਣ ਨਾਲ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਆਉਂਦੀ ਹੈ ਅਤੇ ਹੀਣ ਭਾਵਨਾ ਖਤਮ ਹੁੰਦੀ ਹੈ ਪਰ ਜ਼ਿੰਦਗੀ ਵਿੱਚ ਹਰ ਇੱਕ ਨੂੰ ਕੋਈ ਨਾ ਕੋਈ ਖੇਡ ਖੇਡਣੀ ਚਾਹੀਦੀ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਨੂੰ ਜ਼ਿੰਦਗੀ ਵਿੱਚ ਖੇਡਾਂ ਸਾਡਾ ਜ਼ਿੰਦਗੀ ਦਾ ਹਿੱਸਾ ਹੋਣੀਆਂ ਚਾਹੀਦੀਆਂ ਹਨ ਭਾਰਤ ਵਿੱਚ ਖੇਡਾਂ ਨੂੰ ਉਤਸ਼ਾਹ ਕਰਨ ਲਈ ਬਹੁਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਜਿਵੇਂ ਕਿ ਬਲਾਕ ਪੱਧਰ ਪਿੰਡ ਪੱਧਰ ਦੇ ਉੱਪਰ ਸਟੇਡੀਅਮ ਬਣਾਉਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਨੂੰ ਇੱਕ ਗਰਾਊਂਡ ਦੇ ਵਿੱਚ ਸਾਰੀਆਂ ਸਹੂਲਤਾਂ ਮਿਲ ਸਕਣ ਅਤੇ ਉਸ ਦੇ ਨਾਲ ਹੀ ਬੱਚਿਆਂ ਨੂੰ ਇੱਕ ਚੰਗੇ ਕੋਚ ਦੀ ਜ਼ਰੂਰਤ ਹੁੰਦੀ ਹੈ ਉਹ ਵੀ ਸਰਕਾਰ ਨੂੰ ਜਿਹੜੇ ਚੰਗੇ ਖਿਡਾਰੀ ਹਨ ਉਹਨਾਂ ਦੀਆਂ ਸੇਵਾਵਾਂ ਪਿੰਡਾਂ ਦੇ ਵਿੱਚ ਬਲਾਕਾਂ ਦੇ ਵਿੱਚ ਅਤੇ ਸ਼ਹਿਰਾਂ ਦੇ ਵਿੱਚ ਗਰਾਊਂਡਾਂ ਦੇ ਕੋਚ ਦੇ ਤੌਰ 'ਤੇ ਲੈਣੀਆਂ ਚਾਹੀਦੀਆਂ ਹਨ ਅੱਜ ਕੱਲ੍ਹ ਮੋਬਾਈਲ ਦੇ ਯੁੱਗ ਵਿੱਚ ਬੱਚੇ ਖੇਡਾਂ ਖੇਡਣੀਆਂ ਬਹੁਤ ਘਟਾ ਗਏ ਹਨ ਇਸ ਦੇ ਨਾਲ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਜੋ ਵਿਕਾਸ ਹੋਣਾ ਅਤੇ ਸਰੀਰਿਕ ਤੌਰ 'ਤੇ ਜੋ ਵਿਕਾਸ ਹੋਣਾ ਹੈ ਉਸ ਦੇ ਵਿੱਚ ਘਾਟ ਪਾਈ ਗਈ ਹੈ ਭਾਰਤ ਵਿੱਚ ਵੀ ਇਹ ਚੀਜ਼ਾਂ ਸਾਨੂੰ ਆਮ ਦੇਖਣ ਨੂੰ ਮਿਲ ਰਹੀਆਂ ਹਨ ਖੇਡਾਂ ਲਈ ਉਤਸ਼ਾਹ ਕਰਨ ਲਈ ਸਰਕਾਰ ਨੂੰ ਛੋਟੇ ਤੋਂ ਛੋਟੇ ਇਨਾਮ ਰੱਖਣੇ ਚਾਹੀਦੇ ਹਨ ਤਾਂ ਜੋ ਇੱਕ ਪ੍ਰਕਿਰਿਆ ਦੇ ਤਹਿਤ ਚੰਗੇ ਖਿਡਾਰੀ ਦੀ ਚੋਣ ਹੋਣੀ ਚਾਹੀਦੀ ਹੈ ਸਾਨੂੰ ਹਰ ਇੱਕ ਖਿਡਾਰੀ ਦੇ ਉੱਪਰ ਹਰ ਇੱਕ ਖੇਡ ਦੇ ਵਿੱਚ ਚੰਗੇ ਕੋਚਾਂ ਦੀ ਲੋੜ ਹੈ ਅਤੇ ਚੰਗੇ ਗਰਾਊਂਡਾਂ ਦੀ ਲੋੜ ਹੈ ਤਾਂ ਜੋ ਸਾਡੇ ਬੱਚੇ ਵਿਸ਼ਵ ਪੱਧਰ 'ਤੇ ਖੇਡਾਂ ਦੇ ਵਿੱਚ ਮੱਲਾਂ ਮਾਰ ਸਕਣ ਅਸੀਂ ਅੱਜ ਓਲੰਪਿਕ ਦੇ ਵਿੱਚ ਇੱਕ ਇੱਕ ਦੋ ਦੋ ਮੈਡਲ ਗੋਲਡ ਮੈਡਲਾਂ ਨੂੰ ਤਰਸ ਰਹੇ ਹਾਂ ਜੇਕਰ ਸਾਡੇ ਕੋਲ ਚੰਗੇ ਖਿਡਾਰੀ ਚੰਗੇ ਗਰਾਉਂਡ ਅਤੇ ਚੰਗੇ ਕੋਚ ਹੋਣਗੇ ਤਾਂ ਸਾਡੇ ਬੱਚੇ ਵੀ ਦੂਜੇ ਦੇਸ਼ਾਂ ਵਾਂਗ ਓਲੰਪਿਕ ਦੇ ਵਿੱਚ ਬਹੁਤ ਜ਼ਿਆਦਾ ਮੱਲਾਂ ਮਾਰਨਗੇ ਦੂਸਰੀ ਗੱਲ ਜਿੰਨੇ ਵੀ ਕ੍ਰਾਈਮ ਹਨ ਜੇਕਰ ਖਿਡਾਰੀ ਗਰਾਊਂਡ ਦੇ ਵਿੱਚ ਖੇਡਦਾ ਹੈ ਜਵਾਨੀ ਆਪਣੀ ਗਰਾਉਂਡ ਦੇ ਵਿੱਚ ਲਗਾਉਂਦਾ ਹੈ ਤਾਂ ਇਹ ਕ੍ਰਾਈਮ ਵੀ ਵਿਸ਼ ਦੇਸ਼ ਪੱਧਰ 'ਤੇ ਘੱਟ ਹੋ ਸਕਦਾ ਹੈ ਸਾਡੇ ਖਿਡਾਰੀ ਨੂੰ ਚੰਗੀ ਖੁਰਾਕ ਚੰਗਾ ਗਰਾਊਂਡ ਅਤੇ ਚੰਗੇ ਕੋਚ ਦੀ ਜ਼ਰੂਰਤ ਹੈ ਸਰਕਾਰ ਨੂੰ ਚਾਹੀਦਾ ਹੈ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਲੋਕਾਂ ਨੂੰ ਉਤਸ਼ਾਹ ਕਰਨ ਲਈ ਖਿਡਾਰੀਆਂ ਦੀ ਮਦਦ ਲਈ ਜਾਵੇ ਅਤੇ ਕੋਚਾਂ ਨੂੰ ਗਰਾਊਂਡਾਂ ਦੇ ਵਿੱਚ ਨੌਕਰੀਆਂ ਦਿੱਤੀਆਂ ਜਾਣ